ਮੈਂ ਸ਼ਹਿਰ ਵਿੱਚ ਰਹਿਣ ਵਾਲੀ ਹਾਂ ਸਾਡੇ ਖੇਤਰ ਦੇ ਮੁਤਾਬਕ ਖਾਣ ਪੀਣ ਕੱਪੜੇ ਐਕਸਪੋਰਟ ਸਪੋਰਟਸ ਦਾ ਕਾਰੋਬਾਰ ਸ਼ੁਧੂ ਸ਼ੁਰੂ ਕੀਤਾ ਜਾ ਸਕਦਾ ਹੈ ਸਾਡਾ ਹੈਂਡ ਟੂਲਸ ਵਿੱਚ ਸਾਡੇ ਖੇਤਰ ਵਿੱਚ ਹੈਂਡ ਟੂਲਸ ਜਿੱਦਾਂ ਹੈ ਉਹ ਕਾਰੋਬਾਰ ਵੀ ਸ਼ੁਰੂ ਕੀਤਾ ਜਾ ਸਕਦਾ ਇਹ ਖੇਤਰ ਉੱਪਰ ਦੱਸੇ ਹੋਏ ਗਏ ਕਾਰੋਬਾਰਾਂ ਲਈ ਫੇਮਸ ਹੈ ਸਾਡਾ ਖੇਤਰ ਸਾਡੇ ਖੇਤਰ ਦੀ ਸਪੋਰਟਸ ਇੰਡਸਟਰੀ ਦੁਨੀਆ ਭਰ ਵਿੱਚ ਮਸ਼ਹੂਰ ਹੈ ਦੁਨੀਆ ਦੇ ਜਿੰਨੇ ਵੀ ਮਤਲਬ ਖਿਡਾਰੀਆਂ ਦੇ ਖੇਡਣ ਦਾ ਸਮਾਨ ਆ ਉਹ ਜਲੰਧਰ ਤੋਂ ਐਕਸਪੋਰਟ ਹੁੰਦਾ ਸਾਡਾ ਖੇਤਰ ਖਾਣ ਪੀਣ ਦੇ ਕਾਰੋਬਾਰ ਵਿੱਚ ਵੀ ਸਮਰੱਥ ਹੈ ਸਾਡੇ ਖੇਤਰ ਵਿੱਚ ਲੋਕ ਖਾਣ ਪੀਣ ਦੀਆਂ ਜਗ੍ਹਾਵਾਂ 'ਤੇ ਰੈਸਟੋਰੈਂਟ ਵਿੱਚ ਜਾਣਾ ਬਹੁਤ ਪਸੰਦ ਕਰਦੇ ਨੇ ਅਤੇ ਉੱਥੇ ਜਾ ਕੇ ਆਪਣੇ ਪਰਿਵਾਰ ਨਾਲ ਦੋਸਤਾਂ ਨਾਲ ਸਮਾਂ ਬਤੀਤ ਕਰਨਾ ਬਹੁਤ ਪਸੰਦ ਕਰਦੇ ਨੇ ਜਿਸ ਨਾਲ ਕਿ ਉਹਨਾਂ ਦਾ ਮਨੋਰੰਜਨ ਹੁੰਦਾ ਆਪਣੇ ਪਰਿਵਾਰ ਨਾਲ ਉਹਨਾਂ ਨੂੰ ਮਿਲਣ ਦਾ ਮੌਕਾ ਮਿਲਦਾ ਆਪਸੀ ਮੇਲ ਜੋਲ ਉਹਨਾਂ ਦਾ ਵੱਧਦਾ ਹੈ

ਜਿੱਦਾਂ ਕਿ ਇਹ ਪਰਿਵਾਰ ਨੂੰ ਆਪਸ 'ਚ ਜੋੜੇ ਰੱਖਦਾ ਦੋਸਤਾਂ ਨੂੰ ਮਿੱਤਰਾਂ ਨੂੰ ਦ ਦੁੱਖ ਸੁੱਖ ਸਾਂਝਾ ਕਰਨ ਲਈ ਇੱਕ ਬਹੁਤ ਵਧੀਆ ਜਗ੍ਹਾ ਮੰਨੀ ਜਾਂਦੀ ਆ ਜਿੱਥੇ ਲੋਕ ਮਿਲਦੇ ਨੇ ਆਪਣੀਆਂ ਯਾਦਾਂ ਸਾਂਝੀਆਂ ਕਰਦੇ ਨੇ

ਆਪਣੇ ਆਪਣੀ ਖੁਸ਼ੀ ਮਨਾਉਣ ਦਾ ਇਹ ਕਾਰੋਬਾਰ ਵਿੱਚ ਇਹ ਕਾਰੋਬਾਰ ਸਾਡੇ ਹਿਸਾਬ ਨਾਲ ਬਹੁਤ ਵਧੀਆ ਚੱਲੇਗਾ ਅਗਰ ਜੇ ਅਸੀਂ ਇਹਨੂੰ ਆਪਣੇ ਖੇਤਰ ਵਿੱਚ ਖੋਲ੍ਹਦੇ ਹਾਂ

ਇੰਟੀਰੀਅਰ ਉਹਨਾਂ ਨੂੰ ਪ੍ਰਭਾਵਿਤ ਕਰਦਾ ਅਤੇ ਵਧੀਆ ਫੋਟੋਗ੍ਰਾਫੀ ਵਿੱਚ ਵੀ ਮਦਦ ਕਰਦਾ ਲੋਕਾਂ ਲੋਕ ਉੱਥੇ ਆ ਕੇ ਆਪਣੀ ਤਸਵੀਰਾਂ ਖਿੱਚਦੇ ਨੇ

ਅਸੀਂ ਇੱਥੇ ਆਪਣਾ ਜਨਮਦਿਨ ਮਨਾਇਆ ਸੀ ਲੋਕਾਂ ਪੁਰਾਣੀਆਂ ਉਹਨਾਂ ਦੀਆਂ ਯਾਦਾਂ ਜੋ ਹੈ ਉਹ ਤਾਜ਼ੀਆਂ ਹੁੰਦੀਆਂ ਨੇ

ਇਸ ਕਰਕੇ ਉਹਨਾਂ ਨੂੰ ਵਧੀਆ ਖਾਣਾ ਅਤੇ ਮਾਹੌਲ ਚਾਹੀਦਾ ਹੁੰਦਾ ਇਸ ਕਰਕੇ ਸਾਡੇ ਹਿਸਾਬ ਨਾਲ ਤਾਂ